ਸਾਡੇ ਲੋਕਾਂ 'ਚ ਜ਼ਿਆਦਾਤਰ ਜਿਵੇਂ ਵਿਆਹ ਹੋ ਗਿਆ ਅਤੇ ਪਾਠ ਹੋ ਗਿਆ ਕੋਈ ਜਨਮ ਦਿਨ ਦੀ ਪਾਰਟੀ ਹੋ ਗਈ ਇਹ ਜਿਹੇ ਸਮਾਗਮਾਂ 'ਤੇ ਲੋਕ ਆਪਣਾ ਰਿਸ਼ਤੇਦਾਰਾਂ ਨੂੰ ਆਪਣੇ ਜਿੰਨੇ ਚਾਹੁਣ ਵਾਲੇ ਨੇ ਜਿੰਨਿਆਂ ਨਾਲ ਵਰਤਦੇ ਨੇ ਬੰਦੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਅਤੇ ਸੱਦੇ 'ਤੇ ਇੱਕ ਅਤੇ ਅਤੇ ਇੱਕ ਛੱਤ ਥੱਲੇ ਇਕੱਠੇ ਹੁੰਦੇ ਨੇ ਅਤੇ ਸਾਰੇ ਆਪਣਾ ਜਿਵੇਂ ਡੀ ਜੇ ਹੋ ਗਿਆ ਇਹ ਜਿਹੀ ਪਾਰਟੀ ਵਗੈਰਾ 'ਤੇ ਉਹ ਆਪਣਾ ਨੱਚ ਕੇ ਜਾਂ ਗਾ ਕੇ ਜਾਂ ਕੁਛ ਵੀ ਕਰਕੇ ਉਹਨੂੰ ਵਧੀਆ ਸੈਲੀਬ੍ਰੇਟ ਕਰਦੇ ਨੇ ਅਤੇ ਸਾਰੇ ਇਕੱਠੇ ਹੋ ਕੇ ਆਪਣਾ ਇੱਕ ਦੂਜੇ ਦੀਆਂ ਦੁੱਖ ਦਰਦ ਇੱਕ ਦੂਜੇ ਦੀ ਖੁਸ਼ੀ ਨੂੰ ਵੰਡਦੇ ਨੇ ਇੱਕ ਦੂਜੇ ਨੂੰ ਦੱਸਦੇ ਨੇ ਵੀ ਹਾਂ ਸਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਤੁਹਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਅਤੇ ਹੌਂਸਲਾ ਦਿੰਦੇ ਨੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਨੇ ਅਤੇ ਇਹ ਜਿਹੀਆਂ ਬਹੁਤ ਗੱਲਾਂ ਨੇ ਜਿਹੜੀਆਂ ਇੱਕ ਦੂਜੇ ਨਾਲ ਮਿਲ ਕੇ ਸਾਡੇ ਭਾਈਚਾਰੇ 'ਚ ਹੁੰਦੀਆਂ ਰਹਿੰਦੀਆਂ